ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਮੈਂ ਟੈਲੀਕੋਮ ਤੋਂ ਬੋਲ ਰਿਹਾ ਹਾਂ ਜੀ ਆਪਾਂ ਕੌਣ ਜੀ ਓਕੇ ਓਕੇ ਜੀ ਮੈਮ ਦੱਸੋ ਨਾ ਕੀ ਪ੍ਰੋਬਲਮ ਆ ਰਹੀ ਹੈ ਓਕੇ ਓਕੇ ਮੈਡਮ ਆਪਣੇ ਫੋਨ ਦੀ ਇੱਕ ਸਾਲ ਦੀ ਗਰੰਟੀ ਹੁੰਦੀ ਹੈਗੀ ਤੁਹਾਡੇ ਕੋਲ ਜੋ ਆਪਣੇ ਤੋਂ ਰਸੀਦ ਵਗੈਰਾ ਲੈ ਕੇ ਗਏ ਤੁਸੀਂ ਡੱਬਾ ਇੱਕ ਰਸੀਦ ਹੁੰਦੀ ਇੱਕ ਡੱਬਾ ਹੁੰਦਾ ਉਹ ਤੁਹਾਡੇ ਕੋਲ ਪਿਆ ਪ੍ਰੋਪਰ ਹਾਂਜੀ ਮੈਮ ਉਹ ਤੁਸੀਂ ਲੈ ਆਇਓ ਕੋਈ ਗੱਲ ਨਹੀਂ ਆਪਾਂ ਦੇਖ ਕੇ ਕੀ ਪ੍ਰੋਬਲਮ ਆ ਰਹੀ ਹੈਗੀ ਆਪਾਂ ਚੇਂਜ ਕਰ ਦੇਵਾਂਗੇ ਆਪਣੀ ਵੈਸੇ ਕੰਪਲੇਂਟ ਹੁੰਦੀ ਹੈਗੀ ਕੰਪਨੀ ਦੀ ਹੈ ਇੱਕ ਸਾਈਡ ਹੁੰਦੀ ਹੈਗੀ ਮੇਲ ਅਤੇ ਆਪਾਂ ਨੂੰ ਪਹਿਲਾਂ ਮੇਲ ਕਰਨੀ ਪੈਂਦੀ ਹੈ ਜੀ ਉਹ 'ਤੇ ਉਹ 'ਤੇ ਮੇਲ 'ਤੇ ਕੰਪਲੇਂਟ ਕਰਨੀ ਪੈਂਦੀ ਆ ਫਿਰ ਉਹ ਉਹਨਾਂ ਦਾ ਜੋ ਰਿਪਲਾਈ ਆਉਂਦਾ ਗਾ ਉਹ ਤੁਹਾਨੂੰ ਡੇਟ ਦੇਣਗੇ ਵੀ ਇਸ ਡੇਟ 'ਤੇ ਜਾ ਕੇ ਤੁਸੀਂ ਆਪਣਾ ਫੋਨ ਦੀ ਜੋ ਵੀ ਪ੍ਰੋਬਲਮ ਆ ਤੁਸੀਂ ਉੱਥੇ ਜਾ ਕੇ ਦੁਕਾਨ 'ਤੇ ਜਾ ਕੇ ਦੱਸ ਸਕਦੇ ਹੋ ਤੁਹਾਨੂੰ ਪਹਿਲਾਂ ਕੰਪਲੇਂਟ ਕਰਨੀ ਪੈਣੀ ਹੈਗੀ ਮੇਲ ਆਈ ਡੀ ਹੁੰਦੀ ਹੈਗੀ ਉਹ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਜੀ ਅਤੇ ਵੈਸੇ ਹੋਰ ਕੋਈ ਪ੍ਰੋਬਲਮ ਆ ਰਹੀ ਹੈ ਮੈਡਮ ਫੋਨ 'ਤੇ ਓਕੇ ਓਕੇ ਮੈਡਮ ਉਹ ਇੱਦਾਂ ਵੀ ਹੋ ਸਕਦਾ ਨਾ ਜਿਵੇਂ ਵੀ ਫੋਨ ਆਪਾਂ ਆਨ ਕਰਦੇ ਹਾਂ ਗੇ ਇੱਕੋ ਲਖਤ ਆਪਾਂ ਨੂੰ ਮੈਸੇਜ ਜਾਂ ਕਾਲ ਵਗੈਰਾ ਆਉਣ ਲੱਗ ਜਾਂਦੇ ਨੇ ਉਹ ਫੋਨ ਬਿਜ਼ੀ ਹੋਣ ਲੱਗ ਜਾਂਦਾ ਇਸ ਲਈ ਆਪਾਂ ਨੂੰ ਤਾਂ ਇਹ ਹੋ ਜਾਂਦਾ ਵੀ ਫੋਨ ਹੈਂਗ ਹੋਣ ਲੱਗ ਗਿਆ ਜੀ ਇੱਦਾਂ ਵੀ ਹਾਂਜੀ ਹਾਂਜੀ ਮੈਮ ਜ਼ਰੂਰ ਲੈ ਕੇ ਆਇਓ ਤੁਸੀਂ ਨਾਲ ਲੈ ਆਇਓ ਆਪਾਂ ਜੋ ਤੁਹਾਨੂੰ ਪ੍ਰੋਬਲਮ ਆਉਂਦੀ ਹੈਗੀ ਉਹ ਆਪਾਂ ਹੱਲ ਕਰਕੇ ਦੇਵਾਂਗੇ ਜੀ ਉਹਦਾ ਹਾਂਜੀ